ਕੁਝ ਆਮ ਗਲਤੀਆਂ ਹਨ ਜੋ ਸ਼ੁਰੂਆਤ ਕਰਨ ਵਾਲੇ ਤੈਰਾਕ ਕਰਦੇ ਹਨ ਜੋ ਕਿ ਸਾਡੀ ਤੈਰਾਕੀ ਸਿੱਖਣ ਦੀ ਰਫ਼ਤਾਰ ਨੂੰ ਹੌਲੀ ਕਰ ਸਕਦੀਆਂ ਹਨ ਜਿਵੇਂ ਕਿ ਸਰੀਰ ਨੂੰ ਸਹੀ ਤਰੀਕੇ ਨਾਲ ਸੰਬੁਲਿਤ ਨਾ ਕਰਨਾ ਬਹੁਤੇ ਸ਼ੁਰੂਆਤੀ ਤੈਰਾਕ ਆਪਣੇ ਸਰੀਰ ਨੂੰ ਪਾਣੀ ਵਿੱਚ ਸਿੱਧਾ ਰੱਖਣ ਦੀ ਬਜਾਏ ਥੋੜ੍ਹਾ ਥੱਲੇ ਜਾਂ ਵੱਡਾ ਉੱਚਾ ਰੱਖਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਤੈਰਨਾ ਔਖਾ ਲੱਗਦਾ ਹੈ ਇਸ ਦਾ ਹੱਲ ਇਹ ਹੈ ਕਿ ਪਾਣੀ 'ਚ ਲੰਬੇ ਹੋ ਕੇ ਸਰੀਰ ਨੂੰ ਰਿਲੈਕਸ ਰੱਖੋ ਪੈਰਾਂ ਅਤੇ ਛਾਤੀ ਨੂੰ ਉੱਚਾ ਰੱਖਣ ਦੀ ਕੋਸ਼ਿਸ਼ ਕਰੋ ਦੂਜੀ ਗਲਤੀ ਇਹ ਹੈ ਕਿ ਸਹੀ ਤਰੀਕੇ ਨਾਲ ਸਾਹ ਨਹੀਂ ਲੈਂਦੇ ਬਹੁਤੇ ਸ਼ੁਰੂਆਤੀ ਲੋਕੀਂ ਆਪਣੇ ਪਾਣੀ ਵਿੱਚ ਸਾਹ ਲੈਣ ਤੋਂ ਡਰਦੇ ਹਨ ਜਿਨ੍ਹਾਂ ਨਾਲ ਉਨ੍ਹਾਂ ਦੀ ਸਾਹ ਲੈਣ ਵਿੱਚ ਔਖ ਹੁੰਦੀ ਹੈ ਪਾਣੀ 'ਚ ਮੂੰਹ ਰੱਖ ਕੇ ਸਾਹ ਛੱਡੋ ਅਤੇ ਉੱਪਰ ਆ ਕੇ ਨੱਕ ਜਾਂ ਮੂੰਹ ਨਾਲ ਸਾਹ ਲਓ ਇਸ ਨਾਲ ਇਹ ਗਲਤੀ ਠੀਕ ਹੋ ਸਕਦੀ ਹੈ ਪੈਰਾਂ ਦੀ ਮੁਮੈਂਟ ਗਲਤ ਹੋਣਾ ਕਈ ਵਾਰ ਤੈਰਾਕ ਆਪਣੇ ਪੈਰਾਂ ਨੂੰ ਬਹੁਤ ਤੇਜ਼ ਜਾਂ ਬਹੁਤ ਹੌਲੀ ਹਿਲਾਉਂਦੇ ਹਨ ਜੋ ਕਿ ਉਨ੍ਹਾਂ ਨੂੰ ਉੱਚਾ ਰਹਿਣ ਵਿੱਚ ਮਦਦ ਨਹੀਂ ਕਰਦਾ ਪੈਰਾਂ ਨੂੰ ਛੋਟੇ ਛੋਟੇ ਲਗਾਤਾਰ ਫਿਲਟਰ ਕਿਕਸ ਨਾਲ ਮੂਵ ਕਰਵਾਓ ਪੈਰਾਂ ਨੂੰ ਸਿੱਧਾ ਰੱਖੋ ਅਤੇ ਗੋਡਿਆਂ ਨੂੰ ਜ਼ਿਆਦਾ ਨਾ ਮੋੜੋ ਇਸ ਦਾ ਇਹ ਹੱਲ ਹੈ ਪਾਣੀ ਦਾ ਡਰ ਅਸੀਂ ਕਿਵੇਂ ਦੂਰ ਕਰ ਸਕਦੇ ਹਾਂ ਪਾਣੀ ਨਾਲ ਆਦਤ ਬਣਾਓ ਪਹਿਲਾਂ ਪਾਣੀ 'ਚ ਰਹਿਣ ਦੀ ਕੋਸ਼ਿਸ਼ ਕਰੋ ਹੌਲੀ ਹੌਲੀ ਪਾਣੀ 'ਚ ਖੜ੍ਹੇ ਰਹੋ ਆਪਣੇ ਪੈਰ ਹਿਲਾਓ ਮੂੰਹ 'ਚ ਪਾਣੀ ਲੈਣ ਦੀ ਬਜਾਏ ਨੱਕ ਜਾਂ ਮੂੰਹ 'ਚ ਹੌਲੀ ਹੌਲੀ ਸਾਹ ਛੱਡੋ ਧੰਨਵਾਦ ਜੀ